ਕਿ ਬਣਾਈ ਬੁਣਾਈ ਤਾਂ ਵੀ ਮੈਂ ਆਪਣਾ ਦਾਜ ਆਪ ਹੀ ਬਣਾਇਆ ਆਪਦੀਆਂ ਚਾਦਰਾਂ ਸਰ੍ਹਾਣੇ ਹੋਰ ਸਮਾਨ ਵੀ ਕੱਢਿਆ ਅਤੇ ਸਿਲਾਈ ਮੈਂ ਵੀ ਕੁਆਰੀ ਹੁੰਦੀ ਨੇ ਹੀ ਵੀ ਸ਼ੁਰੂ ਕੀਤੀ ਸੀ ਵੀ ਮੈਨੂੰ ਉਦੋਂ ਇੰਨਾਂ ਸ਼ੌਕ ਵੀ ਨਹੀਂ ਸੀਗਾ ਥੋੜ੍ਹਾ ਜਿਹਾ ਹੈ ਸੀ ਬਸ ਕੱਪੜੇ ਆਪਦੇ ਸਿਊਂ ਕੇ ਆਪ ਹੀ ਪਾਵਾਂ ਅਤੇ ਮੈਨੂੰ ਵੀ ਹੁੰਦਾ ਸੀ ਵੀ ਮੈਨੂੰ ਕਿਸੇ ਦੀ ਫਿਟਿੰਗ ਸ਼ਾਇਦ ਸੈੱਟ ਆਵੇ ਜਾ ਨਾ ਆਵੇ ਮੇਰਾ ਇਹ ਸ਼ੌਕ ਸੀ ਵੀ ਮੈਂ ਆਪ ਦੀ ਵੀ ਆਪਦੇ ਕੱਪੜੇ ਆਪ ਹੀ ਸੀਵਾਂ ਮੈਨੂੰ ਇੰਨੀ ਕੁ ਬਸ ਦਿਲਚਸਪੀ ਹੈਗੀ ਸੀਗੀ ਫਿਰ ਬਾਅਦ 'ਚੋਂ ਵੀ ਉਹ ਵਿਆਹ ਤੋਂ ਬਾਅਦ ਫਿਰ ਮੈਂ ਆਪਣੇ ਕੱਪੜੇ ਵੀ ਥੋੜ੍ਹਾ ਜਿਹਾ ਹੋਰ ਸਿਲਾਈ ਸਿੱਖੀ ਫਿਰ ਮੈਂ ਕੱਪੜੇ ਸਿਊਣੇ ਸ਼ੁਰੂ ਕੀਤੇ ਮੈਨੂੰ ਇਹ ਸੀਗਾ ਵੀ ਮੈਂ ਜਿਵੇਂ ਜਿਵੇਂ ਵੀ ਇਹ ਰੋਜ਼ ਕੁਆਰੀ ਹੁੰਦੀ ਵੀ ਕਹਿੰਦੀ ਸੀ ਵੀ ਆਪ ਦੇ ਕੱਪੜੇ ਆਪ ਸਿਊਂ ਕੇ ਪਾਵਾਂ ਉਸ ਤੋਂ ਬਾਅਦ ਮੈਂ ਵਿਆਹ ਤੋਂ ਬਾਅਦ ਵੀ ਫਿਰ ਆਪਣੇ ਕੱਪੜੇ ਆਪ ਹੀ ਸਟਿਚਿੰਗ ਕੀਤੇ ਉਸ ਤੋਂ ਬਾਅਦ ਵੀ ਮੈਂ ਹੌਲੀ ਹੌਲੀ ਵੀ ਜਿਵੇਂ ਜਿਵੇਂ ਵਲ ਸਿੱਖਿਆ ਕਰਦੀ ਰਹੀ ਫਿਰ ਵੀ ਮੈਂ ਇਸ ਤਰ੍ਹਾਂ ਵੀ ਬਟੀਕ ਖੋਲ੍ਹ ਲਿਆ ਲਿਆ ਅਤੇ ਵੀ ਮੈਨੂੰ ਇਹ ਵੀ ਹੌਲੀ ਹੌਲੀ ਵੀ ਦਿਲਚਸਪੀ ਪੈਦਾ ਹੋ ਗਈ ਵੀ ਹੌਲੀ ਹੌਲੀ ਕੰਮ ਮੇਰਾ ਵੀ ਵੱਧਦਾ ਗਿਆ ਵੀ ਮੈਨੂੰ ਇਸ ਕੰਮ ਮੇਰਾ ਵੱਧਦਾ ਗਿਆ ਮੈਨੂੰ ਇਹ ਸੀ ਵੀ ਚਲੋ ਵੀ ਥੋੜ੍ਹੀ ਬਹੁਤੀ ਕੋਈ ਕਮਾਈ ਤਾਂ ਹੁੰਦੀ ਹੈ ਵਿਹਲੇ ਰਹਿਣ ਨਾਲੋਂ ਤਾਂ ਵੀ ਚੰਗਾ ਹੀ ਹੈ ਬੰਦਾ ਆਪ ਦੀ ਕਮਾਈ ਕਰੇ ਇਸੇ ਲਈ ਧੰਨਵਾਦ